ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੇ ਸਾਨੂੰ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੋਇਆ ਹੈ ਕਿਉਂਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਇਹ ਤਾਂ ਸਾਡਾ ਪਹਿਰਾਵਾ ਆਉਂਦਾ ਹੈ ਅਤੇ ਸਾਡੀ ਬੋਲੀ ਜਿਹੜੀ ਕਿ ਅੱਜ ਕੱਲ੍ਹ ਲੋਕਾਂ ਦੇ ਵਿੱਚ ਬਹੁਤ ਪ੍ਰਚਲਿਤ ਇੱਥੋਂ ਤੱਕ ਕਿ ਬਾਹਰ ਦੇ ਲੋਕ ਵੀ ਪੰਜਾਬੀ ਬੋਲੀ ਦੇ ਬਹੁਤ ਜ਼ਿਆਦਾ ਸ਼ਬਦਾਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਵੀ ਔਰ ਜੇਕਰ ਗੱਲ ਕਰੀਏ ਪਹਿਰਾਵੇ ਦੀ ਅਤੇ ਸਾਡਾ ਪਹਿਰਾਵਾ ਜਿਹੜਾ ਹੈ ਉਹ ਤਾਂ ਅੱਜ ਕੱਲ੍ਹ ਵਿਦੇਸ਼ੀ ਲੋਕ ਵੀ ਪਾਣਾ ਪਸੰਦ ਕਰਦੇ ਨੇ ਜਿਹਦੇ ਵਿੱਚ ਮਸ਼ਹੂਰ ਹੈ ਸਾਡੀ ਪੰਜਾਬੀ ਜੁੱਤੀ ਸਲਵਾਰ ਕਮੀਜ ਸਾਡੀ ਫੁਲਕਾਰੀ ਜੋ ਕਿ ਸਾਡੇ ਪੁਰਾਣੇ ਦਾਦੀਆਂ ਪੜਦਾਦੀਆਂ ਦੇ ਹੱਥਾਂ ਦੇ ਨਾਲ ਕੱਢੀ ਹੋਈ ਸੀ ਔਰ ਉਹਨੂੰ ਕੌਣ ਭੁੱਲੇਗਾ ਜਿਹੜੇ ਅੱਜ ਕੱਲ੍ਹ ਵੱਡੇ ਵੱਡੇ ਹੋਟਲਾਂ ਦੇ ਵਿੱਚ ਉਹਨੂੰ ਇੱਕ ਪੇਂਟਿੰਗ ਦੀ ਤਰ੍ਹਾਂ ਮੜਾ ਕੇ ਬੜੇ ਸੋਹਣੇ ਤਰੀਕੇ ਦੇ ਨਾਲ ਕੰਧਾਂ ਦੇ ਉੱਤੇ ਲਗਾਇਆ ਜਾਂਦਾ ਹੈ ਉਹ ਸਾਡਾ ਹੀ ਤਾਂ ਸੱਭਿਆਚਾਰ ਹੈ ਜਿਹੜਾ ਅੱਜ ਵੱਖ ਵੱਖ ਜਗ੍ਹਾ ਦੇ ਉੱਤੇ ਨਾ ਬੋਲਦੇ ਹੋਇਆ ਵੀ ਉਹਨਾਂ ਦੇ ਵਿੱਚ ਸ਼ਬਦ ਨਹੀਂ ਨੇ ਪਰ ਸ਼ਬਦਾਂ ਤੋਂ ਬਿਨਾਂ ਵੀ ਉਹ ਆਪਣੀ ਪੰਜਾਬੀਅਤ ਨੂੰ ਦਰਸਾ ਰਹੇ ਨੇ ਜਗ੍ਹਾ ਜਗ੍ਹਾ ਲੱਗ ਕੇ ਫੁਲਕਾਰੀ ਜਿਹੜੀ ਹੈ ਉਹ ਸਾਡੇ ਪੰਜਾਬ ਨੂੰ ਗੂੰਜ ਗੂੰਜ ਕੇ ਦੱਸ ਰਹੀ ਹੈ ਕਿ ਮੇਰਾ ਪੰਜਾਬ ਮਹਾਨ ਸੀ ਅਤੇ ਮਹਾਨ ਹੀ ਹੈ ਔਰ ਜੇਕਰ ਗੱਲ ਕਰਾਂ ਭਾਸ਼ਾ ਦੀ ਪਛਾਣ ਪਛਾਣ ਤਾਂ ਆਪਣੇ ਆਪ 'ਚ ਹੀ ਪੰਜਾਬੀਆਂ ਦੀ ਹੋ ਜਾਂਦੀ ਉਹਨਾਂ ਦੀ ਬੋਲੀ ਜਿਹੜੀ ਕਿ ਸਾਰੀ ਦੇਸ਼ ਸਾਰੀ ਦੁਨੀਆ ਦੇ ਵਿੱਚੋਂ ਵੱਖਰੀ ਹੈ ਤੋ ਪੰਜਾਬੀ ਲੋਕਾਂ ਦੀ ਆਪਸੀ ਭਾਸ਼ਾ ਇਹ ਸਾਰੀਆਂ ਚੀਜ਼ਾਂ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਜੇ ਆਪਾਂ ਗੱਲ ਕਰੀਏ ਗਾਣੇ ਅੱਜ ਕੱਲ੍ਹ ਫੋਰਨਰਸ ਜਿਹੜੇ ਨੇ ਵਿਦੇਸ਼ੀ ਲੋਕ ਜਿਹੜੇ ਨੇ ਉਹਨਾਂ ਦੇ ਵਿਆਹਾਂ ਸ਼ਾਦੀਆਂ 'ਚ ਵੀ ਪੰਜਾਬੀ ਗਾਣੇ ਹੀ ਤਾਂ ਹੈ ਜੇ ਗੱਲ ਕਰੀਏ ਹੋਰ ਕਈ ਆਪਣੇ ਸ਼ਹਿਰ ਨੇ ਜਾਂ ਕਸਬੇ ਨੇ ਉਹਨਾਂ ਸਾਰਿਆਂ ਦੇ ਵਿੱਚ ਚਾਹੇ ਹਰਿਆਣਾ ਹੈ ਚਾਹੇ ਉਹ ਜਿਹੜਾ ਮਰਜ਼ੀ ਹੋ ਜਾਏ ਏਰੀਆ ਸਾਰਿਆਂ ਦੇ ਵਿੱਚ ਪੰਜਾਬੀ ਗਾਣੇ ਤੋਂ ਬਿਨਾਂ ਕੋਈ ਵਿਆਹ ਸ਼ਾਦੀ ਮੰਨਿਆ ਨਹੀਂ ਜਾਂਦਾ ਸੋ ਇਸ ਕਰਕੇ ਇਸ ਤੋਂ ਇਲਾਵਾ ਸੱਭਿਆਚਾਰ ਅਤੇ ਭਾਸ਼ਾ ਨੂੰ ਕੀ ਪ੍ਰਭਾਵਿਤ ਕੀਤਾ ਹੋਏਗਾ ਸਾਡੇ ਪੰਜਾਬੀ ਨੇ ਪੰਜਾਬੀ ਸਾਡੀ ਮਾਂ ਬੋਲੀ ਹੈ ਮਾਂ ਬੋਲੀ ਯਾਨੀ ਕਿ ਸਾਡੀ ਰੂਹ ਹੈ ਅਤੇ ਇਸ ਕਰਕੇ ਸਾਡੇ ਹਰ ਖੂਨ ਦੇ ਕਤਰੇ ਕਤਰੇ ਵਿੱਚ ਪੰਜਾਬੀ ਵਸੀ ਹੋਈ ਹੈ